ਹਾਂਜੀ ਮੇਰੇ ਪਿੰਡ ਦੇ ਨੇੜੇ ਬਹੁਤ ਸਾਰੀਆਂ ਭ ਭਜਨ ਮੰਡਲੀਆਂ ਨੇ ਅਤੇ ਮੇਰਾ ਉਹਨਾਂ ਭਜਨ ਮੰਡਲੀਆਂ ਦੇ ਵਿੱਚ ਅਕਸਰ ਜਾਣਾ ਆਉਣਾ ਰਹਿੰਦਾ ਹੈ ਅਤੇ ਉਹ ਭਜਨ ਮੰਡਲੀਆਂ ਦੇ ਵਿੱਚ ਆਪਾਂ ਬਹੁਤ ਸਾਰੇ ਕੀਰਤਨ ਸ਼ਬਦ ਸੁਣੀ ਦੇ ਨੇ ਅਤੇ ਉਹ ਬਹੁਤ ਮਨ ਨੂੰ ਸ਼ਾਂਤੀ ਦੇਣ ਵਾਲੇ ਨੇ ਸ਼ਾਂਤੀ ਦਿੰ ਪ੍ਰਦਾਨ ਕਰਦੇ ਨੇ ਅਤੇ ਮੈਂ ਆਪ ਅਕਸਰ ਹੀ ਆਪਣੇ ਨੇੜੇ ਦੇ ਮੰਦਰ ਦੇ ਵਿੱਚ ਲ ਮੰਦਰ ਲਹਿਰੀ ਸ਼ਾਹ ਮੰਦਰ ਦੇ ਵਿੱਚ ਭਜਨ ਸੁਣਨ ਲਈ ਜਾਂਦੀ ਹਾਂ ਅਤੇ ਉੱਥੇ ਲੋਕ ਬਹੁਤ ਸਾਰੇ ਤਿਉਹਾਰ ਇੱਕਠੇ ਹੋ ਕੇ ਮਨਾਉਂਦੇ ਨੇ ਜਿੱਦਾਂ ਜਨਮ ਅਸ਼ਟਮੀ ਸ਼ਿਵਰਾਤਰੀ ਅਤੇ ਉੱਥੇ ਸ਼ਿਵਰਾਤਰੀ 'ਤੇ ਜਨਮ ਅਸ਼ਟਮੀ ਦੇ ਵਿੱਚ ਲੋਕ ਆਪਣੇ ਆਪਣੇ ਮਨ ਆਪਣੇ ਭਜਨ ਗਾਉਂਦੇ ਨੇ ਅਤੇ ਉਸ ਬਹੁਤ ਸਾਰੇ ਸੰਗੀਤ ਯੰਤਰ ਯੂਸ ਕ ਇਸਤੇਮਾਲ ਕਰਦੇ ਨੇ ਜਿਵੇਂ ਵਾਜਾ ਤਬਲਾ ਹਾਰਮੋਨੀਅਮ ਢੋਲਕੀ ਆਦਿ ਦੀ ਵਰਤੋਂ ਕਰਦੇ ਨੇ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਇਨ੍ਹਾਂ ਨੂੰ ਵਜਾਉਣ ਦੇ ਲਈ ਆਪਸ ਦੇ ਵਿੱਚ ਅੱਗੇ ਤੋਂ ਅੱਗੇ ਵੱਧਦੀਆਂ ਨੇ ਕਿ ਅਸੀਂ ਇਹਨਾਂ ਨੂੰ ਅਸੀਂ ਵਜਾਵਾਂਗੇ ਅਸੀਂ ਅਸੀਂ ਇਸਦੇ ਨਾਲ ਸੰਗੀਤ ਸੁਣਾਵਾਂਗੇ ਅਤੇ ਜਨਮ ਅਸ਼ਟਮੀ ਦੇ ਵਿੱਚ ਪੋਹਾ ਪਹੁੰਚ ਕੇ ਅਸੀਂ ਉੱਥੇ ਚੱਲ ਰਹੇ ਲੰਗਰ ਦਾ ਵੀ ਬਹੁਤ ਜ਼ਿਆਦਾ ਲੰਗਰ ਨੂੰ ਸ ਉਹ ਕਰਦੇ ਨੇ ਸ ਲੰਗਰ ਦੀ ਲੰਗਰ ਚੱਲ ਰਿਹਾ ਹੁੰਦਾ ਹੈ ਉਸਨੂੰ ਬਹੁਤ ਚੰਗੀ ਤਰ੍ਹਾਂ ਆਨੰਦ ਮਾਣਦੇ ਨੇ ਅਤੇ ਮੇਰੇ ਮਨ ਵਿੱਚ ਬਹੁਤ ਸਾਰੇ ਭਜਨ ਉੱਥੇ ਜਾ ਕੇ ਸੁਣਨ ਦੇ ਸੁਣਨ ਅਤੇ ਸੁਣਾਉਣ ਦਾ ਵਿਚਾਰ ਆਉਂਦਾ ਅਤੇ ਅਸੀਂ ਬਹੁਤ ਉੱਥੇ ਜਾ ਕੇ ਕ੍ਰਿਸ਼ਨ ਜੀ ਦਾ ਇੱਕ ਵਾਰ ਚੱਲ ਰਿਹਾ ਸੀ ਪ੍ਰੋਗਰਾਮ ਅਤੇ ਅਸੀਂ ਉੱਥੇ ਕ੍ਰਿਸ਼ਨ ਜੀ ਦੇ ਅ ਸ ਸੰਗੀਤ ਸੁਣਿਆ ਅਤੇ ਕ੍ਰਿਸ਼ਨ ਜੀ ਦਾ ਸੰਗੀਤ ਸੁਣਦੇ ਸੁਣਦੇ ਮੇਰਾ ਵੀ ਮਨ ਹੋਇਆ ਕਿ ਮੈਂ ਉਨ੍ਹਾਂ ਦੇ ਨਾਲ ਆਪਣੇ ਵੀ ਆਪਣਾ ਸੰਗੀਤ ਸ਼ੁ ਉਹ ਕਰਾਂ ਅਤੇ ਮੈਂ ਇੱਕ ਆਪਣਾ ਸੁਣਾ ਸੁਣਿਆ ਸੁਣਾਇਆ ਹੋਇਆ ਸ ਜਿਹੜਾ ਭਜਨ ਆ ਉਹ ਸੁਣਾਉਣਾ ਚਾਹਾਂਗੀ ਸ਼ਬ ਅ ਸ਼ਬਰੀ ਦੇ ਲਈ ਸ਼ਬਰੀ ਦੇ ਉੱਥੇ ਸ਼ ਅ ਕ੍ਰਿਸ਼ਨ ਜੀ ਦੀ ਭਗਤ ਸ਼ਬਰੀ ਦਾ ਸੰਗੀਤ ਸੀਗਾ ਕਿ ਸ਼ਬਰੀ ਬਾਬਾ ਜੀ ਦੇ ਕੋਲ਼ ਆਉਂਦੀ ਆ ਕਿ ਕਿੱਦਾਂ ਉਹ ਹ ਜੋ ਬੇਰ ਆ ਜਿਹੜੇ ਉਹ ਜੂਠੇ ਕਰ ਕਰ ਕੇ ਰੱਖਦੀ ਰਹਿੰਦੀ ਆ ਕਿ ਕ੍ਰਿਸ਼ਨ ਜੀ ਆਉਣਗੇ ਅਤੇ ਮੇਰੇ ਪਰ ਜਿਹੜੇ ਜੂ ਕ ਜੂਠੇ ਕੀਤੇ ਹੋਏ ਬੇਰ ਨੇ ਉਹਨਾਂ ਦਾ ਸਵਾਦ ਚੱਖਣਗੇ ਅਤੇ ਉੱਥੇ ਜਾ ਕੇ ਬਹੁਤ ਸਾਰਾ ਬਹੁਤ ਸਾਰੀਆਂ ਮੰਡਲੀਆਂ ਪਹੁੰਚੀਆਂ ਹੁੰਦੀਆਂ ਨੇ ਅਤੇ ਅਸੀਂ ਉਹਨਾਂ ਮੰਡ ਉਹਨਾਂ ਨੂੰ ਮੰਡਲੀਆਂ ਦੇ ਵਿੱਚ ਸ ਉਹਨਾਂ ਮੰਡਲੀਆਂ ਨੂੰ ਸਾਰੀਆਂ ਨੂੰ ਕੁਛ ਕੁਛ ਟਾਈਮ ਦੇਣਾ ਪੈਂਦਾ ਹੈ ਅਤੇ ਹਰੇਕ ਮੰਡਲੀ ਦਾ ਮਨ ਹੁੰਦਾ ਹੈ ਕਿ ਅਸੀਂ ਆਪਣੇ ਖੁੱਲ੍ਹੇ ਵਿਚਾਰ ਸੁਣਾਈਏ